ਹਾਂਜੀ ਭਾਰਤ ਉੱਦਮੀਆਂ ਲਈ ਇੱਕ ਉੱਭਰਦੇ ਯੁੱਗ ਦਾ ਆਨੰਦ ਮਾਣ ਰਿਹਾ ਹੈ ਇਸ ਗੱਲ ਦੇ ਵਿੱਚ ਪੂਰਾ ਵਜ਼ਨ ਹੈ ਕਿਉਂਕਿ ਅ ਅੱਜ ਦੇ ਟਾਈਮ ਦੇ ਵਿੱਚ ਸਰਕਾਰਾਂ ਨਵੇਂ ਤਰ੍ਹਾਂ ਦੀਆਂ ਨੀਤੀਆਂ ਲੈ ਕੇ ਆ ਰਹੀਆਂ ਹਨ ਤਾਂ ਕਿ ਲੋਕਾਂ ਨੂੰ ਨਵੇਂ ਤਰ੍ਹਾਂ ਦਾ ਕਾਰੋਬਾਰ ਸ਼ੁਰੂ ਕਰਨ 'ਚ ਮੱਦਦ ਮਿਲ ਸਕੇ ਜਿਵੇਂ ਕਿ ਲੋਨ ਦੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਲੇਡੀਜ ਨੂੰ ਵੀ ਇਹਦੇ ਵਿੱਚ ਪਹਿਲੇ ਛੋਟੇ ਲੋਨ ਦਿੱਤੇ ਜਾਂਦੇ ਸਨ ਜਿੱਦਾਂ ਕਿ ਚਾਰ ਪੰਜ ਲੱਖ ਦੇ ਵਿੱਚ ਹੀ ਹੁੰਦੇ ਸਨ ਪਰ ਹੁਣ ਉਹ ਪੰਜਾਹ ਲੱਖ ਤੱਕ ਵੀ ਲਿਮਿਟ ਵਧਾ ਦਿੱਤੀ ਗਈ ਹੈ ਅਤੇ ਉਹ 'ਚ ਕਿ ਕੋਈ ਗਰੰਟੀ ਵਗੈਰਾ ਨਹੀਂ ਲੈ ਰਹੇ ਤਾਂ ਕਿ ਉਹਨਾਂ ਦੇ ਦਿਮਾਗ 'ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਬੋਝ ਨਾ ਪਵੇ ਨਾਲੇ ਨਵੇਂ ਕਾਰੋਬਾਰਾਂ ਦੇ ਵਿੱਚ ਸਬਸਿਡੀ ਦਾ ਵੀ ਇੱਕ ਨਵਾਂ ਰੋਲ ਪ੍ਰੇਅ ਕਰ ਰਹੀ ਹੈ ਜਿੱਦਾਂ ਕਿ ਕਿਸੇ ਨੇ ਜੇ ਪੰਜਾਹ ਲੱਖ ਲਾਇਆ ਹੈ ਤਾਂ ਉਹਨੂੰ ਵੀਹ ਤੀਹ ਪਰਸੈਂਟ ਸਬਸਿਡੀ ਵੀ ਦਿੱਤੀ ਜਾਂਦੀ ਹੈ ਤਾਂ ਕਿ ਉਹਨੂੰ ਸਟਾਰਟ ਦੇ ਵਿੱਚ ਹੀ ਚੰਗਾ ਮੁਨਾਫ਼ਾ ਪ੍ਰਾਪਤ ਹੋ ਜਾਵੇ ਇਸ ਤਰ੍ਹਾਂ ਸਰਕਾਰਾਂ ਬਹੁਤ ਵਧੀਆ ਵਧੀਆ ਉਪਰਾਲੇ ਕਰ ਰਹੀਆਂ ਹਨ ਧੰਨਵਾਦ